ਹੈਲੋ ਠੀਕ ਹੈ ਤੁਸੀਂ ਸੁਣਾਓ ਕਿੱਦਾਂ ਹੂ ਹੋਰ ਅੱਜ ਕੱਲ੍ਹ ਕੁਛ ਨਹੀਂ ਘਰ ਦੇ ਕੰਮ ਹੀ ਨਹੀਂ ਖ਼ਤਮ ਹੁੰਦੇ ਤੁਹਾਨੂੰ ਪਤਾ ਹੀ ਹੈ ਸਾਰਾ ਦਿਨ ਆਹੋ ਗੋਬਿੰਦ ਟੈਂਥ ਕਰ ਬੈਠਾ ਹੁਣ ਪਲੱਸ ਵਨ ਦਾ ਸੋਚਦੇ ਪਏ ਕਿੱਥੇ ਪਾਵਾਂ ਹਾਂ ਈ ਇੱਕ ਦੋ ਦੇਖੇ ਨੇ ਸਕੂਲ ਮਾਊਂਟ ਕਾਰਮਲ ਵਾ ਜਾਂ ਮਾਊਂਟ ਕਾਰਮਲ ਠੀਕ ਲੱਗਦਾ ਪਿਆ ਮੈਨੂੰ ਅਤੇ ਹਾਂਜੀ ਹਾਂਜੀ ਅਤੇ ਡੀ ਏ ਵੀ ਸਕੂਲ ਉਨ੍ਹੇ ਨੌਨ ਮੈਡੀਕਲ ਰੱਖਣਾ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਪਤਾ ਕਰਕੇ ਲੱਗਣਾ ਹੁਣ ਕਿਹੜਾ ਕਿਹੜਾ ਸਕੂਲ ਪਾਈਏ ਏ ਹੈ ਹਾਂ ਸਕੂਲ ਜਾ ਕੇ ਪਤਾ ਲ ਸਕੂਲ ਜਾ ਕੇ ਪਤਾ ਲੱਗੂਗਾ ਹੁਣ ਦੇਖਦੇ ਇਹਨੂੰ ਕਿਹੜੇ ਸਕੂਲ ਪਾਈਏ ਹਾਂ ਹਾਂ ਜੈਨ ਡੇ ਬੋਡਿੰਗ ਸਕੂਲ ਗਏ ਸੀ ਉਹ ਮੈਨੂੰ ਠੀਕ ਲੱਗਾ ਉਹ ਸੀ ਬੀ ਐਸ ਈ ਵੀ ਹੈਗਾ ਹਾਂਜੀ ਹਾਂਜੀ ਉੱਥੇ ਸੋਚਦੇ ਪਏ ਉੱਥੇ ਪਾਈਏ ਅਸੀਂ ਸਕੂਲ ਅੱਛਾ ਅੱਛਾ ਫਿਰ ਹੂ ਹੂ ਠੀਕ ਅੱਛਾ

ਅੱਛਾ ਅੱਛਾ ਹਾਂ ਹਾਂ ਚਾਰਜ ਵਗੈਰਾ ਅੱਛ ਅੱਛਾ ਹੂ ਹੂ ਹਾਂ ਉਹ ਦੇਖਦੇ ਜਾ ਕੇ ਨਾ ਕੀ ਕਿਹੜਾ ਸਕੂਲ ਠੀਕ ਹੈ ਅੱਛ ਅੱਛਾ ਗਏ ਸੀ ਤੁਸੀਂ ਡੀ ਏ ਵੀ ਅੱਛ ਅੱਛਾ ਉੱਥੇ ਚਾਰ ਅੱਛ ਅੱਛਾ ਚਾਰਜਜ ਵਗੈਰਾ ਠੀਕ ਹੂੰ ਹੂੰ ਅੱਛਾ ਅੱਛਾ ਹੂੰ ਹੂੰ ਹਾਂਜੀ ਹਾਂਜੀ ਹਾਂ ਮੈਂ ਮੈਂ ਮੈਂ ਸੀ ਬੀ ਐਸ ਈ ਜ਼ਿਆਦਾ ਪ੍ਰੈਫਰ ਕਰਦੀ ਹੈ ਸੀ ਬੀ ਐਸ ਈ ਠੀਕ ਰਹੇ ਬੱਚੇ ਨੂੰ ਹਾਂਜੀ ਹਾਂ ਹਾਂ ਬਚ ਬੱਚੇ ਸ਼ੁਰੂ ਤੋਂ ਪੜ੍ਹਦੇ ਪਏ ਨਾ ਸੀ ਬੀ ਐਸ ਈ ਫਿਰ ਸੋਚਦੇ ਬੱਚੇ ਸੋ ਬੱਚੇ ਕਹਿੰਦੇ ਕੀ ਅਸੀਂ ਸੀ ਬੀ ਐਸ ਈ ਪੜ੍ਹੀਏ ਪੰਜਾਬ ਬੋਰਡ ਇਨ੍ਹਾਂ ਨੂੰ ਸੂਟ ਨਹੀਂ ਕਰਨਾ ਉਹ ਹੈ ਜੀ ਪੰਜਾਬ ਬੋਰਡ ਦੀ ਪੜ੍ਹਾਈ ਹਾਂਜੀ ਹਾਂਜੀ ਹਾਂ ਬਸ ਫਿਰ ਇਹ ਦੇਖਦੇ ਪਏ ਹੈ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੂੰ ਹੂੰ ਮੈਂ ਤਾਂ ਜੈਨ ਜੈਨ ਡੇ ਬੋਰਡਿੰਗ ਜਾਊਗੀ ਚੌਧਰੀ ਬਲਬੀਰ ਸਿੰਘ ਅਤੇ ਮਾਊਂਟ ਕਾਰਮਲ ਤਾਂ ਛੱਡ ਹੀ ਦਓ ਉਹ ਤਾਂ ਆਈ ਸੀ ਐਸ ਈ ਹੈ ਨਾ ਉਹ ਤਾਂ ਨਹੀਂ ਜਾਣਗੇ ਅਤੇ ਰਾਇਤ ਬਾਹਰਾ ਵੀ ਇੱਕ ਰਾਇਤ ਬਾਹਰਾ ਵੀ ਸੋਚਦੇ ਪਏ ਅੱਛਾ ਅੱਛਾ ਠੀਕ ਆ ਠੀਕ ਆ ਹਾਂ ਉੱਥੇ ਠੀਕ ਆ ਅੱਛਾ ਜੀ ਹੂੰ ਹੂੰ ਹਾਂਜੀ ਹਾਂਜੀ ਮੈਂ ਵੀ ਹਾਂਜੀ ਵੀ ਇਹ ਸੋਚਿਆ ਕਿ ਪੜ੍ਹਾਈ ਵੀ ਅੱਛੀ ਹੈ ਅਤੇ ਹਾਂਜੀ ਹਾਂਜੀ ਹਾਂ ਹਾਂ ਅੱਛ ਅੱਛਾ

ਅੱਛਾ ਅੱਛਾ ਹੂੰ ਹੂੰ ਹਾਂਜੀ ਹਾਂਜੀ ਪੜ੍ਹਾਈ ਤਾਂ ਬਹੁਤ ਅੱਛੀ ਹੈ ਨਾ ਹਾਂਜੀ ਹੂੰ ਹੂੰ ਹੂੰ ਹੂੰ ਹਾਂ ਪੜ੍ਹਾਈ ਤਾਂ ਬਹੁਤ ਪੜ੍ਹਾਈ ਤਾਂ ਬਹੁਤ ਵਧੀਆ ਨਾ ਮੇਰੇ ਨੇਬਰ ਪੜੋਸੀ ਦੇ ਬੱਚੇ ਇੱਥੇ ਪੜ੍ਹੇ ਨੇ ਸਾਰੇ ਪੜ੍ਹਾਈ ਬਹੁਤ ਅੱਛੀ ਹੈ ਹਾਂਜੀ ਹਾਂਜੀ ਹੂੰ ਹਾਂ ਨਹੀਂ ਕੋਈ ਐਸੀ ਅਸੀਂ ਵੀ ਜੈਨ ਡੇ ਬੋਡਿੰਗ ਪਾਉਂਗੇ ਸਕੂਲ 'ਚ ਫਿਰ ਤਾਂ ਅਸੀਂ ਹਾਂ ਇਹ ਸੋਚਿਆ ਹਾਂ ਚਲੋ ਠੀਕ ਹੈ ਨਾ ਹਾਂ ਓਕੇ ਬਾਏ ਜੀ ਬਾਏ ਥੈਂਕ ਯੂ ਜੀ ਭਾਜੀ